ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਟੂਰਿਸਟ ਗਾਰਡ ਬੋਲ ਦੇ ਜੈ ਆ ਭਾਅ ਜੀ ਤਿੰਨ ਦਿਨਾਂ ਦਾ ਸਾਡਾ ਫੈਮਲੀ ਦਾ ਪਲੈਨ ਸੀ ਅੰਮ੍ਰਿਤਸਰ ਆਉਣ ਦਾ ਅਤੇ ਮੈਨੂੰ ਸੂਜੈਸਟ ਕਰ ਦਿਓ ਕਿ ਕਿੱਥੇ ਕਿੱਥੇ ਤੁਸੀਂ ਘੁੰਮਾ ਦਿਓਗੇ ਅਤੇ ਹੋਟਲ ਵਗੈਰਾ ਵੀ ਤੁਸੀਂ ਅਰੇਂਜ ਕਰ ਦਿਓਗੇ ਅਤੇ ਭਾਅ ਜੀ ਖਰਚਾ ਵੀ ਦੱਸ ਦਿਓ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਹਾਂਜੀ ਓਕੇ ਭਾਅ ਜੀ ਓਕੇ ਓਕੇ ਭਾਅ ਜੀ ਅਤੇ ਆਹ ਤੁਹਾਡਾ ਹੀ ਨੰਬਰ ਨਾ ਤੁਹਾਡਾ ਭਾਅ ਜੀ ਓਕੇ ਭਾਅ ਜੀ ਧੰਨਵਾਦ ਭਾਅ ਜੀ ਹਾਂਜੀ ਭਾਅ ਜੀ ਆ ਜਾਵਾਂਗੇ ਓਕੇ